ਸਤਿ ਸ਼੍ਰੀ ਅਕਾਲ ਜੀ ਮੈਂ ਰਵੀ ਗੱਲ ਕਰ ਰਿਹਾ ਸਰ ਮੈਂ ਤੁਹਾਡੀ ਨਾ ਵੈਬਸਾਈਟ ਤੋਂ ਇੱਕ ਸਰ ਬੋਡੀ ਵੋਸ਼ ਮੰਗਵਾਇਆ ਸੀਗਾ ਅਤੇ ਸਰ ਇੱਕ ਤਾਂ ਸਰ ਉਹਨੂੰ ਆਉਣ 'ਚ ਤੁਸੀਂ ਮੈਨੂੰ ਹਫ਼ਤੇ ਦਾ ਟਾਈਮ ਦਿੱਤਾ ਸੀਗਾ ਸਰ ਉਹ ਸਰ ਇੱਕ ਹਫਤੇ ਦੀ ਬਜਾਏ ਸਰ ਉਹਨੇ ਦੋ ਹਫਤੇ ਲਾ 'ਤੇ ਆਉਣ ਨੂੰ ਅਤੇ ਸਰ ਮੈਂ ਬੜਾ ਹੀ ਪਰੇਸ਼ਾਨ ਹੋਇਆ ਅਤੇ ਮੈਂ ਚੈੱਕ ਕਰਦਾ ਰਿਹਾ ਬਾਰ ਬਾਰ ਕਿ ਕਦੋਂ ਆਉਣਾ ਏ ਇਹਨੇ ਕਦੋਂ ਆਉਣਾ ਏ ਏ ਅਤੇ ਸਰ ਉਹ ਤੋਂ ਬਾਅਦ ਸਰ ਥੋੜ੍ਹਾ ਜਿਹਾ ਡਿਲੀਵਰੀ ਬੋਆਏ ਸਰ ਉਹਨੇ ਸਰ ਮੈਨੂੰ ਬਹੁਤ ਜ਼ਿਆਦਾ ਦਿੱਕਤ ਕੀਤੀ ਹੈ ਅਤੇ ਸਰ ਚਲੋ ਉਹ ਤੋਂ ਬਾਅਦ ਜ ਜਦੋਂ ਮੈਨੂੰ ਜਿਹੜਾ ਆਪਣਾ ਪ੍ਰੋਡਕਟ ਹੈ ਸਰ ਜਦੋਂ ਮੈਨੂੰ ਮੈਂ ਰਸੀਵ ਕੀਤਾ ਅਤੇ ਸਰ ਉਹ ਤੋਂ ਬਾਅਦ ਸਰ ਉਹਦੀ ਮੈਂ ਐਕਸਪਾਇਰੀ ਵਗੈਰਾ ਚੈੱਕ ਕੀਤੀ ਸਰ ਜਿਹੜੀ ਇਹਦੀ ਐਕਸਪਾਇਰੀ ਡੇਟ ਆ ਸਰ ਉਹ ਬਿਲਕੁਲ ਹੀ ਨੇੜੇ ਸੀਗੀ ਐਕਸਪਾਇਰੀ ਹੋਣ ਦੇ ਅਤੇ ਸਰ ਚਲੋ ਜਦੋਂ ਮੈਂ ਇਹਨੂੰ ਖੋਲ੍ਹਿਆ ਅਤੇ ਮੈਨੂੰ ਪਹਿਲਾਂ ਤਾਂ ਸਰ ਇੱਕ ਅਜੀਬ ਤਰ੍ਹਾਂ ਦੀ ਸਮੈੱਲ ਹੀ ਆਈ ਅਤੇ ਮੈਨੂੰ ਲੱਗਾ ਸਰ ਕਿਤੇ ਕਿ ਆਈ ਥਿੰਕ ਕੋਈ ਨਿਊ ਇਹਨਾਂ ਨੇ ਕੋਈ ਫਲੇਵਰ ਵਗੈਰਾ ਐਡ ਕੀਤਾ ਹੋਣਾ ਕੁਛ ਜਾਂ ਕੋਈ ਨਿਊ ਸੋਲਟ ਅਤੇ ਸਰ ਅਜੀਬ ਸਮੈੱਲ ਹੋਣ ਦੇ ਬਾਵਜੂਦ ਜਦੋਂ ਮੈਂ ਉਹਨੂੰ ਥੋੜ੍ਹਾ ਆਪਣੀ ਚਮੜੀ 'ਤੇ ਅਪਲਾਈ ਕੀਤਾ ਉਹਨੂੰ ਤਾਂ ਉਹਦੇ ਅਪਲਾਈ ਕਰਨ ਤੋਂ ਬਾਅਦ ਦੋ ਸੈਕਿੰਡ ਤੱਕ ਠੀਕ ਰਿਹਾ ਬਟ ਥੋੜ੍ਹਾ ਜਦੋਂ ਟਾਈਮ ਕੋਈ ਵੱਧਦਾ ਗਿਆ ਤਾਂ ਮੇਰੀ ਜਿਹੜੀ ਚਮੜੀ ਆ ਉੱਥੇ ਜਲਨ ਸ਼ੁਰੂ ਹੋ ਗਈ ਅਤੇ ਜਲਨ ਦੇ ਸ਼ੁਰੂ ਹੋਣ ਦੇ ਨਾਲ ਮੈਂ ਜਦੋਂ ਵੀ ਉਹਨੂੰ ਧੋਇਆ ਅਤੇ ਉਹ ਤੋਂ ਬਾਅਦ ਉੱਥੇ ਰੇਸ਼ੇਜ਼ ਮੇਰੇ ਸਟਾਰਟ ਹੋ ਗਏ ਹੋਣੇ ਅਤੇ ਉਹ ਤੋਂ ਬਾਅਦ ਉਹ ਜਿਹੜੀ ਮੇਰੀ ਚਮੜੀ ਉਹਦਾ ਕਲਰ ਵਗੈਰਾ ਬਿਲਕੁਲ ਚੇਂਜ ਹੋ ਗਿਆ ਜਿਹੜਾ ਮੈਂ ਫਲੇਵਰ ਮੰਗਵਾਇਆ ਸੀਗਾ ਉਹ ਮੈਨੂੰ ਬਿਲਕੁਲ ਸੇਫ ਨਹੀਂ ਹੋਇਆ ਅਤੇ ਸਰ ਜੇ ਕੋਈ ਮੈਨੂੰ ਅੱਗੇ ਪਿੱਛੇ ਕੋਈ ਮੈਨੂੰ ਪੁੱਛੇਗਾ ਕਿ ਹਾਂ ਕਿਤੇ ਜਿਹੜੀ ਵੈਬਸਾਈਟ ਹੈ ਉਨ੍ਹਾਂ ਦੀ ਟਰੱਸਟੇਬਲ ਹੈ ਜਾਂ ਨਹੀਂ ਅਤੇ ਸਰ ਮੈਂ ਤਾਂ ਉਹਨਾਂ ਨੂੰ ਬਿਲਕੁਲ ਕਵਾਂ ਕਿ ਇਹ 'ਤੇ ਬਿਲਕੁਲ ਟਰੱਸਟ ਨਾ ਕਰੋ ਅਤੇ ਸਰ ਇਹ ਬਿਲਕੁਲ ਵੇਸਟੇਜ਼ ਆਫ ਮਨੀ ਹੈ ਅਤੇ ਸਰ ਇਹਦਾ ਇੱਕੋ ਹੀ ਹੱਲ ਹੈ ਸਰ ਮੈਂ ਚਾਹੁੰਦਾ ਕਿ ਜਿਹੜੇ ਮੇਰੇ ਬਣਦੇ ਮੇਰੇ ਪੈਸੇ ਨੇ ਅਤੇ ਉਹ ਮੈਨੂੰ ਮੇਰੇ ਵਾਪਿਸ ਕੀਤੇ ਜਾਣ